ਹਾਂਜੀ ਮੈਂ ਨਾ ਟੈਕ ਟੈਕਸੀ ਮੈਂ ਸਿਮਰਦੀਪ ਮੈਂ ਟੈਕਸੀ ਬੁੱਕ ਕਰਨੀ ਸੀ ਪਰਸੋਂ ਪਰਸੋਂ ਅਸੀਂ ਜਾਣਾ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਹਾਂਜੀ ਅਸੀਂ ਸੱਤ ਅੱਠ ਜਣੇ ਹੈ ਮੇਰੇ ਬ੍ਰਦਰ ਹੈ ਮਾਤਾ ਪਿਤਾ ਹੈ ਚਾਚਾ ਚਾਚੀ ਅਤੇ ਤਾਇਆ ਤਾਈ ਹੈ ਅਤੇ ਅਸੀਂ ਪਰਸੋਂ ਜਾਣਾ ਹੈ ਸਵੇਰੇ ਛੇ ਵਜੇ ਮੈਂ ਰੋ ਨਵਾਂ ਸ਼ਹਿਰ ਤੋਂ ਬੋਲਦੀ ਹਾਂ ਰੈਲ ਮਾਜਰੇ

ਓਕੇ ਜੀ ਪੇਅਮੈਂਟ ਅਡਵਾਂਸ ਕਰਨੀ ਕਿ ਘਰੇ ਆ ਕੇ ਓਕੇ ਪਰਸੋਂ ਜਾਣਾ ਤੁਸੀਂ ਆ ਜਾਓਗੇ ਟਾਈਮ 'ਤੇ ਸਵੇਰੇ ਓਕੇ ਇਹ ਰੈਲ ਮਾਜਰਾ ਉਹ ਪੈਟਰੋਲ ਪੰਪ ਪਤਾ ਤੁਹਾਨੂੰ ਹਾਂਜੀ ਹਾਂਜੀ ਹਾਂਜੀ ਉਹਦੇ ਜਿਹੜਾ ਪੁੱਲ ਨਹੀਂ ਹੈ ਪੁੱਲ ਦੇ ਇੱਧਰ ਹੈ ਰਾਈਟ ਹੈਂਡ ਹਾਂਜੀ ਹਾਂਜੀ ਓਕੇ ਮੈਂ ਲੌਕੇਸ਼ਨ ਭੇਜ਼ ਦਿੰਦੀ ਹਾਂਜੀ ਹਾਂਜੀ ਓਕੇ ਓਕੇ